ਭਾਰਤ ਵਿੱਚ ਪਹਿਰਾਵਾ ਵ ਸਭ ਤੋਂ ਵਧੀਆ ਕਮੀਜ਼ ਸਲਵਾਰ ਚੱਲਦਾ ਵਾ ਲੇਡੀਜ ਦਾ ਮੁ ਮੁਟਿਆਰਾਂ ਲਈ ਇਹ ਹੀ ਓ ਵਧੀਆ ਚੱਲਦਾ ਪੁਰਾਣੇ ਜ਼ਮਾਨੇ ਤੋਂ ਚੱਲਿਆ ਹੈ ਜਿਹੜਾ ਪਹਿਰਾਵਾ ਬਣਿਆ ਲੇਡੀਜ ਸਲਵਾਰ ਕਮੀਜ਼ ਬਣਿਆ ਦੁਪੱਟਾ ਹੋਰ ਕੋਈ ਵਧੀਆ ਨਹੀਂ ਪਰ ਹੁਣ ਤਾਂ ਫੈਸ਼ਨ ਬਦਲ ਗਿਆ ਨਵੇਂ ਨਮੂਨੇ ਚੱਲ ਗਏ ਕੋਈ ਪਲਾਜੋ ਬਣਾਈ ਜਾਂਦਾ ਕੋਈ ਕੁਛ ਬਣਾਈ ਜਾਂਦਾ ਪਰ ਜਿਹੜਾ ਸਹੀ ਮਾਇਨਾ ਰੱਖਦਾ ਸਲਵਾਰ ਕਮੀਜ਼ 'ਚ ਵਧੀਆ ਲੱਗਦਾ ਸਾਨੂੰ ਤਾਂ ਇਹ ਹੀ ਵਧੀਆ ਰਹਿੰ ਲੱਗਦਾ ਊਂ ਪਹਿਨਣ ਨੂੰ ਤਾਂ ਜਿਹੜਾ ਕੁਛ ਮਰਜ਼ੀ ਪਹਿਨੀ ਜਾਓ ਜੋ ਮਰਜ਼ੀ ਪਜਾਮੀਆਂ ਪਾ ਲਓ ਪਜਾਮੇ ਪਾ ਲਓ ਪਲਾਜੋ ਸੂਟ ਪਾ ਲਓ ਲਹਿੰਗੇ ਪਾ ਲਓ ਸ਼ਹਿੰਗੇ ਪਾ ਲਓ ਪਰ ਪੰਜਾਬੀ ਪਹਿਰਾਵਾ ਸਭ ਤੋਂ ਵਧੀਆ ਪਹਿਰਾਵਾ ਪੁਰਾਣੇ ਪੁਰਾਣਾ ਪਹਿਰਾਵਾ ਪੁਰਾਣਾ ਹੀ ਹੈ ਜੋ ਬਣਿਆ ਸਲਵਾਰ ਕਮੀਜ ਪਰ ਅਸੀਂ ਇੱਕ ਦੁਕਾਨ ਤੋਂ ਸੂਟ ਖਰੀਦਿਆ ਸਾਨੂੰ ਇੰਨਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਣਾ ਕੇ ਮਨ ਖੁਸ਼ ਹੋ ਗਿਆ ਪਾਇਆ ਐਡਾ ਸੋਹਣਾ ਲੱਗਿਆ ਹਰੇਕ ਪੁੱਛੇ ਕਿੱਥੋਂ ਲਿਆਂਦਾ ਕਿਹੜੀ ਦੁਕਾਨ ਤੋਂ ਲਿਆਂਦਾ ਕਿੰਨਾ ਕਿੰਨਾ ਵਧੀਆ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਉਸ ਤਰ੍ਹਾਂ ਦਾ ਪਹਿਰਾਵਾ ਸਾਰਿਆਂ ਨੂੰ